ਦੋ ਦਸੰਬਰ ਦੋ ਹਜ਼ਾਰ ਪੰਦਰਾਂ ਸਤਾਈ ਜੁਲਾਈ ਉੱਨੀ ਸੌ ਸਤਾਸੀ ਪੰਦਰਾਂ ਨਵੰਬਰ ਉੱਨੀ ਸੌ ਉਣਾਨਵੇਂ ਪੰਦਰਾਂ ਅਗਸਤ ਉੱਨੀ ਸੌ ਪਚੱਤਰ ਤਿੰਨ ਮਾਰਚ ਉੱਨੀ ਸੌ ਪਚਾਸੀ